ਹੈਲੋ ਸਤਿ ਸ਼੍ਰੀ ਅਕਾਲ ਮੈਮ ਮੈਮ ਮੈਂ ਯਸ਼ਿਕਾ ਬੋਲ ਰਹੀ ਹਾਂ ਤੁਸੀਂ ਯੋੋਗਾ ਇੰਸਟਕਚਰ ਵਾਲੇ ਟੀਚਰ ਅੱਛਾ ਮੈਮ ਮੈਂ ਨਾ ਯੋਗਾ ਬਾਰੇ ਪੁੱਛਣਾ ਸੀ ਮੈਮ ਤੁਹਾਡੀ ਤੁਸੀਂ ਯੋਗਾ ਕਿੰਨੇ ਵਜੇ ਤੱਕ ਕਰਵਾਉਂਦੇ ਹੋ ਕਿਵੇਂ ਕਦੋਂ ਰਾਤੀ ਮੈਮ ਅੱਛਾ ਠੀਕ ਹੈ ਮੈਮ ਅਤੇ ਨਾ ਅਸੀਂ ਨਾ ਵੈਸੇ ਤਾਂ ਸੱਤ ਜਣੇ ਹੈਗੇ ਹਾਂ ਯੋਗਾ ਸਿੱਖਣ ਵਾਲੇ ਅਤੇ ਤੁਸੀਂ ਟਾਈਮਿੰਗ ਕਦੋਂ ਸੈੱਟ ਆਊਗੀ ਤੁਹਾਨੂੰ ਅੱਛਾ ਮੈਮ ਅਤੇ ਬੈਚ ਦਾ ਕੀ ਸਿਸਟਮ ਹੈ ਕਦੋਂ ਤੋਂ ਸਟਾਰਟ ਨੇ ਅਸੀਂ ਬੱਚੇ ਤਾਂ ਮੈਮ ਸੱਤ ਜਣੇ ਹਾਂ ਠੀਕ ਹੈ ਮੈਮ ਅਤੇ ਨਾਲ ਫੀਸ ਕਿੰਨੀ ਕੁ ਹੈ ਮੈਮ ਕੋਈ ਡਿਸਕਾਊਂਟ ਠੀਕ ਹੈ ਪਰ ਪਰਸਨ ਠੀਕ ਹੈ ਮੈਮ ਅਤੇ ਫਿਰ ਹੁਣ ਕੱਲ੍ਹ ਤੋਂ ਆ ਜੀਏ ਅਸੀਂ

ਠੀਕ ਹੈ ਠੀਕ ਹੈ ਮੈਮ ਅਤੇ ਮੈਮ ਬੋਇਜ ਦਾ ਕੀ ਸਿਸਟਮ ਹੈ ਇਕੱਠਾ ਹੀ ਹੁੰਦਾ ਜਾਂ ਕੋਈ ਅਲੱਗ ਬੈਚ ਹੈ ਠੀਕ ਹੈ ਮੈਮ ਓਕੇ ਥੈਂਕ ਯੂ